ਇੱਕ ਨਵੰਬਰ ਉੱਨੀ ਸੌ ਸਤਾਸੀ ਚਾਰ ਨਵੰਬਰ ਉੱਨੀ ਸੌ ਬਿਆਸੀ ਛੇ ਨਵੰਬਰ ਉੱਨੀ ਸੌ ਸਤਾਸੀ ਅੱਠ ਨਵੰਬਰ ਉੱਨੀ ਸੌ ਸਤਾਸੀ ਨੌ ਨਵੰਬਰ ਉੱਨੀ ਸੌ ਬੱਨਵੇ